ਬਚਪਨ ਦੀਆਂ ਸਾਡੀਆਂ ਸਭ ਤੋਂ ਮਨਮੋਹਕ ਯਾਦਾਂ ਹਨ ਖੇਡਾਂ ਅਤੇ ਆਪਣੇ ਮਾਤਾ ਪਿਤਾ ਦਾ ਪਿਆਰ ਜਿਹੜੀਆਂ ਖੇਡਾਂ ਅਸੀਂ ਬਚਪਨ ਵਿੱਚ ਖੇਡੀਆਂ ਹਨ ਉਹ ਹੁਣ ਦੁਬਾਰਾ ਨਹੀਂ ਆਉਂਦੀਆਂ ਉਹ ਅੱਜ ਕੱਲ੍ਹ ਦੇ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਕਿ ਉਹ ਖੇਡਾਂ ਕੀ ਹੁੰਦੀਆਂ ਹਨ ਅਸੀਂ ਜਦੋਂ ਖੇਡਦੇ ਸੀ ਤਾਂ ਅਸੀਂ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਆਪਣੇ ਆਪਣੇ ਘਰਾਂ ਤੋਂ ਬਾਹਰ ਜਾ ਕੇ ਕਿਤੇ ਖੁੱਲ੍ਹੀ ਜਗ੍ਹਾ 'ਤੇ ਖੇਡਦੀਆਂ ਸਾਂ ਜਦੋਂ ਅਸੀਂ ਖੇਡਾਂ ਸ਼ੁਰੂ ਕਰਦੇ ਸਾਂ ਤਾਂ ਸਾਨੂੰ ਘਰੋਂ ਬੜੀਆਂ ਹੀ ਆਵਾਜ਼ਾਂ ਪੈਂਦੀਆਂ ਸਨ ਜਿਸ ਕਰਕੇ ਅਸੀਂ ਆਪਣੀ ਖੇਡ ਵਿੱਚ ਇੰਨੇ ਮਸਤ ਹੋ ਜਾਂਦੇ ਸੀ ਕਿ ਸਾਨੂੰ ਆਪਣੇ ਘਰਦਿਆਂ ਦੀ ਆਵਾਜ਼ਾਂ ਵੀ ਸੁਣਾਈ ਨਹੀਂ ਸੀ ਦਿੰਦੀਆਂ ਜਦੋਂ ਅਸੀਂ ਆਪਣੇ ਖੇਡਾਂ ਵਿੱਚ ਇੰਨਾ ਰੁੱਝ ਜਾਂਦੇ ਸੀ ਕਿ ਅਸੀਂ ਇੱਕ ਦੂਜੇ ਨਾਲ ਖੇਡ ਖੇਡ ਵਿੱਚ ਲੜ ਵੀ ਪੈਂਦੇ ਸੀ ਅਤੇ ਅਸੀਂ ਫੇਰ ਉਹਨਾਂ ਨਾਲ ਹੀ ਖੇਡਣ ਲੱਗ ਪੈਂਦੇ ਸੀ ਸਾਨੂੰ ਆਪਣੀ ਸਭ ਤੋਂ ਪਿਆਰੀਆਂ ਖੇਡਾਂ ਬਹੁਤ ਹੀ ਜ਼ਿਆਦਾ ਖੇਡਾਂ ਪਿਆਰੀਆਂ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਪਿਆਰੀ ਖੇਡ ਸੀ ਸਾਡੀ ਖੋ ਖੋ ਜਾਂ ਤੁਸੀਂ ਲਗਾ ਲਓ ਜਿਸ ਤਰ੍ਹਾਂ ਸਟੈਪੂ ਹੁੰਦਾ ਹੈ ਜਾਂ ਕੋਈ ਗੀਹਟੇ ਖੇਡਣੇ ਇਹ ਸਾਡੀਆਂ ਬਹੁਤ ਹੀ ਚੰਗੀਆਂ ਖੇਡਾਂ ਸੀ ਜਦੋਂ ਅਸੀਂ ਇਹ ਖੇਡਾਂ ਖੇਡਦੇ ਸਾਂ ਸਾਨੂੰ ਸਮੇਂ ਦਾ ਪਤਾ ਨਹੀਂ ਸੀ ਲੱਗਦਾ ਕਿ ਅਸੀਂ ਕਦੋਂ ਦੇ ਘਰੋਂ ਬਾਹਰ ਖੇਡਣ ਲਈ ਆਏ ਹਾਂ ਜਦੋਂ ਅਸੀਂ ਖੇਡ ਕੇ ਘਰ ਜਾਂਦੇ ਸੀ ਤਾਂ ਸਾਨੂੰ ਘਰੋਂ ਜਾ ਕੇ ਝਿੜਕਾਂ ਵੀ ਪੈਂਦੀਆਂ ਸਨ ਤਾਂ ਵੀ ਅਸੀਂ ਖੁਸ਼ ਹੋ ਕੇ ਕਹਿੰਦੇ ਸਾਂ ਅਸੀਂ ਖੇਡਣ ਗਏ ਸੀ ਤਾਂ ਕੀ ਹੋ ਗਿਆ ਜਦੋਂ ਅਸੀਂ ਆਪਣੇ ਖੇਡ ਵਿੱਚ ਇੰਨਾ ਰੁੱਝ ਜਾਂਦੇ ਸਾਂ ਕਿ ਸਾਨੂੰ ਆਪਣੀ ਖੇਡ ਬੜੀ ਹੀ ਚੰਗੀ ਲੱਗਦੀ ਸੀ ਜਿਸ ਦੇ ਬਾਅਦ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਕਹਿੰਦੇ ਹਾਂ ਕਿ ਹੁਣ ਉਹ ਸਮਾਂ ਨਹੀਂ ਆਉਂਦਾ ਤੁਸੀਂ ਵੀ ਖੇਡਾਂ ਖੇਡਣੀਆਂ ਸ਼ੁਰੂ ਕਰੋ ਪਰ ਅੱਜ ਕੱਲ੍ਹ ਦੇ ਬੱਚੇ ਫੋਨਾਂ ਵਿੱਚ ਹੀ ਲੱਗੇ ਰਹਿੰਦੇ ਹਨ ਅਤੇ ਉਹ ਅੱਜ ਕੱਲ੍ਹ ਇਹ ਖੇਡਾਂ ਨਹੀਂ ਖੇਡਦੇ ਹੁਣ ਤਾਂ ਉਹ ਸਮਾਂ ਯਾਦ ਕਰਕੇ ਸਾਨੂੰ ਐਨਾ ਅਗਰ ਬੁਰਾ ਲੱਗਦਾ ਹੈ ਕਿ ਉਹ ਸਮਾਂ ਫਿਰ ਕਦੋਂ ਆਵੇਗਾ ਅਤੇ ਤੁਹਾਡੇ ਲਈ ਸ ਅਸੀਂ ਇਹੀ ਕਹਿੰਦੇ ਹਾਂ ਕਿ ਉਹ ਸਮਾਂ ਫਿਰ ਤੋਂ ਆਏ ਅਤੇ ਅਸੀਂ ਉਹ ਖੇਡਾਂ ਫਿਰ ਤੋਂ ਖੇਡੀਏ